ਹੈਲੋ ਸਰ ਤੁਸੀਂ ਫਲਿੱਪਕਾਰਟ 'ਚੋਂ ਬੋਲਦੇ ਹੋ ਮੈਂ ਇੱਕ ਕੰਪਲੇਂਟ ਕਰਨੀ ਸੀ ਦਰਅਸਲ ਮੈਂ ਪਿਛਲੇ ਪਿਛਲੀ ਦਸ ਤਰੀਕ ਨੂੰ ਫਲਿੱਪਕਾਰਟ ਤੋਂ ਇੱਕ ਟੀ ਵੀ ਆਡਰ ਕੀਤਾ ਸੀ ਅਤੇ ਇੱਕ ਤਾਂ ਉਹ ਟੀ ਵੀ ਮੇਰੇ ਕੋਲ ਡਿਲੀਵਰੀ ਡੇਟ ਤੋਂ ਆਇਆ ਹੀ ਤਿੰਨ ਚਾਰ ਦਿਨ ਲੇਟ ਹੈ ਅਤੇ ਉੱਪਰੋਂ ਮੈਂ ਟੀ ਵੀ ਐੱਲ ਜੀ ਦਾ ਮੰਗਵਾਇਆ ਸੀ ਅਤੇ ਮੇਰੇ ਕੋਲ ਸੈਮਸੰਗ ਦਾ ਆਇਆ ਅਤੇ ਜਿਹੜੀ ਪੈਕਿੰਗ ਵਿੱਚ ਆਏ ਉਹ ਪੈਕਿੰਗ ਵੀ ਖੋਲ੍ਹੀ ਅਤੇ ਫਟੀ ਹੋਈ ਸੀ ਜਿਹੜਾ ਡਿਲੀਵਰੀ ਬੋਆਏ ਆਇਆ ਸੀ ਮੈਂ ਉਹਦੇ ਅੱਗੇ ਹੀ ਟੀ ਵੀ ਓਪਨ ਕੀਤਾ ਸੀ ਅਤੇ ਉਹ ਅਤੇ ਮੈਂ ਵੀਡੀਓ ਵੀ ਰਿਕਾ ਰਿਕਾਰਡ ਕਰ ਲਈ ਸੀ ਅਤੇ ਮੇਰੇ ਕੋਲ ਸਾਰੇ ਸਬੂਤ ਹਨ ਅਤੇ ਮੈਂ ਦੋ ਵਾਰ ਕੰਪਲੇਂਟ ਵੀ ਕਰ ਦਿੱਤੀ ਹੈ ਕਿਰਪਾ ਕਰਕੇ ਮੈਨੂੰ ਐੱਲ ਜੀ ਦੇ ਹੀ ਐੱਲ ਜੀ ਦਾ ਹੀ ਟੀ ਵੀ ਦਿੱਤਾ ਜਾਣਾ ਚਾ ਚਾਹੀਦਾ ਫਿਰ ਮੇਰੇ ਜਾਂ ਫਿਰ ਮੇਰੇ ਪੈਸੇ ਵਾਪਸ ਕੀਤੇ ਜਾਣ